ਸਾਡੇ ਸ਼ਹਿਰ ਰੋਪੜ ਦਾ ਇਤਿਹਾਸਿਕ ਪੱਖੋਂ ਕਾਫੀ ਮਹੱਤਵਪੂਰਨ ਸਥਾਨ ਹੈ ਜਿਵੇਂ ਕਿ ਇਹ ਸ਼ਹਿਰ ਸਤਲੁਜ ਕੰਢੇ ਵਸਿਆ ਹੋਇਆ ਇੱਕ ਸ਼ਹਿਰ ਹੈ ਜਿਸਦਾ ਇਤਿਹਾਸਿਕ ਪਿਛੋਕੜ ਦੇਖੀਏ ਤਾਂ ਸਤਲੁਜ ਦੇ ਕੰਢੇ 'ਤੇ ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ ਡਲਹੋਜੀ ਵੱਲੋਂ ਇੱਕ ਸੰਧੀ ਕੀਤੀ ਗਈ ਸੀ ਜਿਸ ਦੇ ਪ੍ਰਮਾਣ ਅੱਜ ਵੀ ਸਾਨੂੰ ਸਤਲੁਜ ਕੰਢੇ 'ਤੇ ਮਿਲਦੇ ਹਨ ਇਹ ਇਤਿਹਾਸਿਕ ਪੱਖੋਂ ਕਾਫੀ ਮਹੱਤਵਪੂਰਨ ਸਥਾਨ ਹੈ ਇੱਦਾਂ ਹੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਸਾਜਿਆ ਗਿਆ ਸੀ ਅਨੰਦਪੁਰ ਸਾਹਿਬ ਵੀ ਸਾਡੇ ਰੋਪੜ ਸ਼ਹਿਰ ਦਾ ਹੀ ਇੱਕ ਹਿੱਸਾ ਹੈ ਜੋ ਕਿ ਇਤਿਹਾਸਿਕ ਪੱਖੋਂ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਗੁਰਦੁਆਰੇ ਸ਼੍ਰੀ ਭੱਠਾ ਸਾਹਿਬ ਵਿਖੇ ਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਾਫੀ ਵਾਰ ਯਾਤਰਾਵਾਂ ਇੱਧਰੋਂ ਕੀਤੀਆਂ ਗਈਆਂ ਜਦੋਂ ਮੁਗਲਾਂ ਦੇ ਨਾਲ ਲੜਾਈਆਂ ਹੋ ਰਹੀਆਂ ਸਨ ਤਾਂ ਇਸ ਰਸਤਿਓ ਰਾਹੀਂ ਸਿੱਖ ਫੌਜ ਅਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹਨਾਂ ਰਸਤਿਆਂ 'ਤੇ ਹੀ ਯਾਤਰਾ ਕੀਤੀ ਗਈ ਸੀ ਅਤੇ ਸ਼੍ਰੀ ਚਮਕੌਰ ਸਾਹਿਬ ਦੀ ਗੜੀ ਵਿਖੇ ਵੀ ਇਤਿਹਾਸਿਕ ਪੱਖੋਂ ਕਾਫੀ ਮਹੱਤਵਪੂਰਨ ਘਟਨਾਵਾਂ ਹਨ ਜੋ ਕਿ ਇਤਿਹਾਸ ਵਿੱਚ ਕਾਫੀ ਅਹਿਮ ਹਨ ਵੱਡੇ ਸਾਹਿਬਜਾਦੇ ਸ਼੍ਰੀ ਅਜੀਤ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਬਾਕੀ ਸਿੰਘਾਂ ਨੇ ਵੀ ਉੱਥੇ ਸ਼ਹੀਦੀਆਂ ਦਿੱਤੀਆਂ ਜੋ ਕਿ ਅੱਜ ਸ਼੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ ਇਹ ਵੀ ਸਾਡੇ ਰੋਪੜ ਸ਼ਹਿਰ ਦੇ ਵਿੱਚ ਹੀ ਮੌਜੂਦ ਹਨ ਇਤਿਹਾਸ ਦੇ ਪੱਖੋਂ ਸਾਡੇ ਸ਼ਹਿਰ ਦੇ ਵਿੱਚ ਅਨੇਕਾਂ ਅਜਿਹੀਆਂ ਸਥਾਨ ਹਨ ਜੋ ਕਿ ਇਤਿਹਾਸ ਨੂੰ ਆਪ ਦਰਸਾਉਂਦੇ ਹਨ ਧੰਨਵਾਦ